ਜਿਵੇਂ ਕਿ ਮੇਰਾ ਜ਼ਿਲ੍ਹਾ ਬਰਨਾਲਾ ਹੈ ਬਰਨਾਲਾ ਸ਼ਹਿਰ ਨਹੀਂ ਬਰਨਾਲੇ ਤੋਂ ਵੀਹ ਕਿਲੋਮੀਟਰ ਦੂਰ ਇੱਕ ਕਸਬਾ ਹੈ ਤਪਾ ਮੰਡੀ ਇਥੋਂ ਜਿਹੜੇ ਕਾਰੀਗਰ ਹਨ ਜਿਵੇਂ ਕਿ ਹਰ ਖੇਤਰ ਦੇ ਚ ਕਾ ਕਾਰੀਗਰ ਹੁੰਦੇ ਹਨ ਜਿਵੇਂ ਲੱਕੜ ਦਾ ਕਾਰੀਗਰ ਚਿਣਾਈ ਦਾ ਕਾਰੀਗਰ ਅਤੇ ਹੋਰ ਬਹੁਤ ਸਾਰੇ ਟੀ ਵੀ ਰਿਪੇਅਰ ਦਾ ਕਾਰੀਗਰ ਤਾਂ ਸਰਕਾਰ ਦੀਆਂ ਵੀ ਵੱਖ ਵੱਖ ਸਕੀਮਾਂ ਹੁੰਦੀਆਂ ਹਨ ਕਿ ਇਹਨਾਂ ਕਾਰਾਆ ਕਾਰੀਗਰਾਂ ਨੂੰ ਜਿਹੜੇ ਹੱਥੀਂ ਕਿਰਤ ਕਰਦੇ ਹਨ ਜਿਹਨਾਂ ਕੋਲ ਕਿਸੇ ਕਲਾ ਦਾ ਹੁਨਰ ਹੁੰਦਾ ਹੈ ਉਸ ਹੁਨਰ ਨੂੰ ਵਧਾਵਾ ਦਿੱਤਾ ਜਾਵੇ ਉਸ ਨੂੰ ਵੰਡਿਆ ਜਾਵੇ ਅਤੇ ਇਹਨਾਂ ਕਾਰੀਗਰਾਂ ਦੀ ਜਿਹੜੀ ਕਲਾ ਨੂੰ ਉਹਨਾਂ ਨੂੰ ਸੁਰੱਖਿਅਤ ਹਿਤ ਰੱਖਿਆ ਜਾਵੇ ਕਿਉਂਕਿ ਕੁਝ ਕਾਰੀਗਰ ਦੀ ਜਿਹੜੀ ਕਲਾ ਹੁੰਦੀ ਉਹ ਇੰਨੀ ਬਾਹਕਮਾਲ ਹੁੰਦੀ ਹੈ ਪਰ ਪੈਸੇ ਦੀ ਤੰਗੀ ਹੋਣ ਕਾਰਨ ਉਹ ਆਪਣੀ ਜਿਹੜੀ ਕਲਾ ਗਈ ਉਹ ਕੁਝ ਚੰਦ ਪੈਸਿਆਂ ਵਾਸਤੇ ਉਹ ਕੰਮ ਕਰਦੇ ਹਨ ਜਾਂ ਵੇਚਦੇ ਹਨ ਸੋ ਸਰਕਾਰ ਨੇ ਇਹਨਾਂ ਕਾਰੀਗਰਾਂ ਲਈ ਇੱਕ ਵਿਸ਼ੇਸ਼ ਸਹੂਲਤਾਂ ਲੈ ਕੇ ਆਉਣੀਆਂ ਚਾਹੀਦੀਆਂ ਹਨ ਜਿਹਦੇ ਵਿੱਚ ਇਹਨਾਂ ਨੂੰ ਕਰਜ਼ੇ ਜਾਂ ਸਬਸਿਡੀ ਜਾਂ ਫਡਿੰਗ ਦੀਆਂ ਕੁਝ ਕਿਸਮਾਂ ਨੂੰ ਮਾਨਤਾ ਦੇਣੀ ਚਾਹੀਦੀ ਹੈ ਜਿਵੇਂ ਕਿ ਜੇ ਇਹ ਕਰਜ਼ੇ ਲੈਂਦੇ ਹਨ ਤਾਂ ਇਹਨਾਂ ਨੂੰ ਕਰਜ਼ੇ ਦੇ ਵਿੱਚ ਛੂਟ ਹੋਣੀ ਚਾਹੀਦੀ ਹੈ ਇਹਨਾਂ ਨੂੰ ਸਬਸਿਡੀਆਂ ਮਿਲਣੀਆਂ ਚਾਹੀਦੀਆਂ ਹਨ ਕਿਉਂਕਿ ਇਹ ਇਹਨਾਂ ਦੀ ਕਲਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਇਹਨਾਂ ਦੀ ਜਿਹੜੀ ਕਲਾ ਗੀ ਉਹ ਬੇਸ਼ਕੀਮਤੀ ਹੈ ਵੱਡਮੁੱਲੀ ਹੈ ਜਿਵੇਂ ਹੁਣ ਅਸੀਂ ਲੱਕੜ ਦੇ ਮਿਸਤਰੀ ਦੀ ਗੱਲ ਕਰਦੇ ਹਾਂ ਕਿਉਂਕਿ ਲੱਕੜ ਦਾ ਜਿਹੜਾ ਕੰਮ ਹੈ ਉਹ ਅੱਜ ਕੱਲ੍ਹ ਤਾਂ ਆਧੁਨਿਕ ਮਸ਼ੀਨਾਂ ਆ ਚੁੱਕੀਆਂ ਹਨ ਪਰ ਜਿਹੜਾ ਕਲਾ ਹੱਥ ਨਾਲ ਵਿਅਕਤੀ ਕਰਦਾ ਹੈ ਜੋ ਹੱਥ ਨਾਲ ਕੁਝ ਕਿਸੇ ਚੀਜ਼ ਨੂੰ ਤਰਾਸ਼ਦਾ ਹੈ ਉਸ ਦੀ ਕਲਾ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਤਾਂ ਅਜਿਹੇ ਕਾਰੀਗਰ ਅਲੋਪ ਹੋ ਰਹੇ ਹਨ ਸਾਡੇ ਸੱਭਿਆ ਆਪਣੇ ਸਾਡੇ ਵਿਰਸੇ ਵਿੱਚੋਂ ਕਿਉਂਕਿ ਚ ਪਹਿਲਾਂ ਲੋਕ ਹੱਥੀਂ ਕਿਰਤ ਕਰਨ ਵਿੱਚ ਵਿਸ਼ਵਾਸ ਰੱਖਦੇ ਸੀਗੇ ਤਾਂ ਅਜਿਹੇ ਕਾਰੀਗਰ ਅੱਜ ਵੀ ਮੌਜੂਦ ਨੇ ਜੋ ਕਿ ਕੰਮ ਕਰ ਰਹੇ ਨੇ ਇਹਨਾਂ ਨੂੰ ਕਰਜ਼ੇ ਦੀ ਜਾਂ ਸਬਸਿਡੀਆਂ ਦੀ ਜਾਂ ਫੰਡਿੰਗ ਦੀ ਲੋੜ ਹੈ ਤਾਂ ਜੋ ਇਹ ਆਪਣੀ ਜਿਹੜੀ ਕਲਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਵੰਡਣ ਸਿਖਾਉਣ ਕਿਉਂਕਿ ਅਜੋਕੀ ਪੀੜ੍ਹੀ ਇਹ ਕੰਮ ਨਹੀਂ ਸਿੱਖਣਾ ਚਾਹੁੰਦੀ ਕਿਉਂਕਿ ਇਸ ਵਿੱਚ ਪੈਸਾ ਬਹੁਤ ਘੱਟ ਹੈ ਇਸ ਲਈ ਉਹ ਆਪਣੇ ਵਿਰਸੇ ਤੋਂ ਦੂਰ ਹੋ ਰਹੇ ਹਨ